ਹਾਂਜੀ ਕਿਵੇਂ ਹੋ ਮੈਂ ਪੂਜਾ ਬੋਲਦੀ ਪਈ ਹਾਂ ਆਰਵ ਦੀ ਮੰਮੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਹੋਰ ਸਿਹਤਾਂ ਕਿਵੇਂ ਨੇ ਅੱਛਾ ਜੀ ਐਰੋ ਉਹੀ ਹੈ ਦਵਾਈਆਂ 'ਤੇ ਚੱਲੀ ਜਾਂਦੇ ਹੈ ਮੈਂ ਇਹੀ ਪੁੱਛਦੀ ਸੀ ਆਰਵ ਨੂੰ ਹੁਣ ਸਕੂਲ ਲਾਨਾ ਗਾ ਇਹ ਢਾਈ ਸਾਲ ਦਾ ਹੋ ਗਿਆ ਹਾਂਜੀ ਮੈਂ ਕਿਹਾ ਹੁਣ ਸਕੂਲ ਲਾ ਦਈਏ ਹੁਣ ਘਰੇ ਤਾਂ ਤੁਹਾਨੂੰ ਪਤਾ ਟਿਕਦੇ ਨਹੀਂ ਇਹ ਬੱਚੇ ਤਾਂ ਫਿਰ ਮੈਂ ਹਾਂ ਹਾਂ ਪਹਿਲਾਂ ਪਲੇਅਵੇ 'ਚ ਲੱਗਿਆ ਹੋਇਆ ਗਾ ਹੁਣ ਉਹ ਉੱਥੇ ਲਾਣਾ ਗਾ ਸਕੂਲ ਦੇ ਵਿੱਚ ਕਲਾਸ ਏ ਨਰਸਰੀ 'ਚ ਹਾਂਜੀ ਅੱਛਾ ਜੀ ਅੱਛਾ ਜੀ ਮੈਂ ਕਿਹਾ ਮੈਂ ਤੁਹਾਨੂੰ ਪੁੱਛਲਾ ਵੀ ਕਿਹੜਾ ਸਕੂਲ ਵਧੀਆ ਫਿਰ ਉਹ 'ਚ ਲਾ ਦਿੰਦੀ ਹੈਗੀ ਕਿਉਂਕਿ ਬੇਸ ਬੱਚੇ ਦਾ ਬੇਸ ਸਟਰੋਂਗ ਫੇਰ ਹੀ ਆ ਹਾਂਜੀ ਸਾਰੇ ਸਹੀ ਹੈ ਹਾਂਜੀ ਅੱਛਾ ਜੀ ਇਹ ਕਿਹੜੀ ਰੋਡ 'ਤੇ ਪੈ ਜਾਂਦਾ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਜੀ ਹਮ ਹਮ ਹਾਂਜੀ ਐਕਟੀਵਿਟੀ ਵਗੈਰਾ ਕਰਾਉਂਦੇ ਇਹ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਪੌਣੇ ਤਿੰਨ ਸਾਲਾਂ ਦਾ ਲੱਗ ਜੇ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਫੀਸ ਤਾਂ ਬੱਚੇ ਦਾ ਬੇਸ ਹੋ ਜਾਵੇ ਉਹਦੇ ਵਰਗੀ ਰੀਸ ਨਹੀਂ ਹੈਗੀ ਅੱਛਾ ਜੀ ਫਿਰ ਵੀ ਠੀਕ ਹੈ ਹਾਂਜੀ ਹਾਂਜੀ ਨਹੀਂ ਉਹਦੀ ਸਤਾਰ੍ਹਾਂ ਸੌ ਰੁਪਇਆ ਤਾਂ ਮੈਂ ਉੱਥੇ ਭਰਦੀ ਪਲੇਅਵੇਅ ਵਿੱਚ ਭਰਦੀ ਸਤਾਰ੍ਹਾਂ ਸੌ ਰੁਪਇਆ ਤਾਂ ਮੈਂ ਵੀ ਤਾਂ ਹੀ ਫਿਰ ਉੱਥੇ ਅਠਾਰ੍ਹਾਂ ਕੁ ਜਾਇਜ਼ ਹੈ ਹਮ ਹਮ ਹਾਂਜੀ ਨਹੀਂ ਕਹਿੰਦੇ ਨਾਲੇ ਕੇਵੀ ਸਕੂਲ ਵੀ ਨਹੀਂ ਨਹੀਂ ਦੀਦੀ ਇੱਕ ਕਹਿੰਦੇ ਕੇਵੀ ਸਕੂਲ ਵੀ ਵਧੀਆ ਹੈਗਾ ਜਿਹੜਾ ਸ਼ੋਨੀ ਦੇ ਅੰਦਰ ਆਉਂਦਾ ਆਪਣੇ ਹਾਂਜੀ ਨਹੀਂ ਮੈਨੂੰ ਸਾਰੇ ਕਹਿੰਦੇ ਵੀ ਇੱਕ ਕੇਵੀ ਵਧੀਆ ਇੱਕ ਜਿਹੜਾ ਤੁਸੀਂ ਦੱਸ ਰਹੇ ਇਹ ਵਧੀਆ ਮੈਂ ਕਿਹਾ ਵੀ ਦੀਦੀ ਨੂੰ ਪੁੱਛ ਲੈਂਦੀ ਜਿਹੜਾ ਹੁਣ ਤੁਸੀਂ ਇਹ ਕਹਿ ਤਾ ਇਹਦੇ ਵਿੱਚ ਹੀ ਲਗਾ ਦਿੰਦੀ ਫੇਰ ਇਹਨੂੰ ਮੈਂ ਅਤੇ ਦਾਖਲਾ ਕਿਵੇਂ ਹੋਵੇਗਾ ਇਹਦੇ ਵਿੱਚ ਪਹਿਲਾਂ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਨਹੀਂ ਬੈਂਕ ਤਾਂ ਆਪਣੇ ਘਰ ਦੇ ਨੇੜੇ ਵੀ ਲੱਗਦਾ ਉਹ ਤਾਂ ਕੋਈ ਦਿੱਕਤ ਨਹੀਂ ਹੈਗੀ ਅੱਛਾ ਚਲ ਕੋਈ ਨਾ ਉਹ ਤਾਂ ਸਕੂਲ ਵਾਲੇ ਦਸ ਹੀ ਦੇਣਗੇ ਮੈਨੂੰ ਸਾਰਾ ਅੱਛਾ ਚਲੋ ਕੋਈ ਨਹੀਂ ਫੇਰ ਦੀਦੀ ਮੈਂ ਜਾਂਦੀ ਹਾਂ ਜੇ ਕੁਛ ਨਾ ਪਤਾ ਲੱਗਿਆ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਜੇ ਕੁਛ ਨਾ ਮੈਨੂੰ ਪਤਾ ਲੱਗਾ ਤੁਹਾਨੂੰ ਫੋਨ ਕਰ ਲੂੰਗੀ ਘੱਟ ਵੀ ਹੋ ਜਾਂਦੀ ਅੱਛਾ ਜੀ ਨਹੀਂ ਨਹੀਂ ਅਸੀਂ ਤਾਂ ਇੱਕ ਹੀ ਲਾਉਣਾ ਹਾਂਜੀ ਜੀ ਅੱਛਾ ਜੀ ਚਲੋ ਕੋਈ ਗੱਲ ਨਹੀਂ ਫਿਰ ਉਹ ਤਾਂ ਕੋਈ ਗੱਲ ਨਹੀਂ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਮੈਂ ਫਿਰ ਕੱਲ੍ਹ ਜਾਂਦੀ ਹਾਂ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਠੀਕ ਹੈ ਦੀਦੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਦੀਦੀ ਠੀਕ ਠੀਕ ਹੈ ਦੀਦੀ ਸਤਿ ਸ਼੍ਰੀ ਅਕਾਲ